ਫਿਸ਼ਿੰਗ ਦਾ ਕੰਮ ਮੈਂ ਸ਼ੌਕੀਆ ਤੌਰ 'ਤੇ ਕਰਦਾ ਸੀ ਪ੍ਰੋਫੈਸ਼ਨਲ ਮੈਂ ਕਦੇ ਨਹੀਂ ਕੀਤਾ ਅੱਜ ਦੇ ਟਾਈਮ ਦੇ ਵਿੱਚ ਵਿਗਿਆਨ ਦਾ ਯੁੱਗ ਹੈ ਇੰਟਰਨੈੱਟ ਦਾ ਜ਼ਮਾਨਾ ਹੈ ਬੱਚਿਆਂ ਲਈ ਅੱਗੇ ਉਹਨਾਂ ਦੇ ਫਿਊਚਰ ਲਈ ਬਹੁਤ ਵਧੀਆ ਸਕੋਪ ਨੇ ਜਿਸਦੇ ਵਿੱਚ ਬੱਚਾ ਆਪਣੇ ਫਿਊਚਰ ਨੂੰ ਬਰਾਈਟ ਕਰ ਸਕਦਾ ਹੈ ਅੱਗੇ ਵਧ ਸਕਦਾ ਹੈ ਅਤੇ ਮੈਂ ਇਸ ਚੀਜ਼ ਨੂੰ ਕਦੇ ਲਾਈਕ ਨਹੀਂ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਇਸ ਲਾਈਨ 'ਚ ਪੈਣ ਆਪਣਾ ਫਿਊਚਰ ਉਹ ਇੰਟਰਨੈੱਟ ਦੇ ਜ਼ਰੀਏ ਬਰਾਈਟ ਕਰ ਸਕਦੇ ਨੇ ਵਿਗਿਆਨਿਕ ਤੌਰ 'ਤੇ ਬਰਾਈਟ ਕਰ ਸਕਦੇ ਨੇ